ਇੱਕ ਜਨਵਰੀ ਉੱਨੀ ਸੌ ਇਕਹੱਤਰ ਪੰਜ ਫਰਵਰੀ ਉੱਨੀ ਸੌ ਬਾਹਠ ਸੱਤ ਜਨਵਰੀ ਉੱਨੀ ਸੌ ਤ੍ਰੇਂਹਠ ਪੰਜ ਪੰਜ ਫਰਵਰੀ ਉੱਨੀ ਸੌ ਬਾਈ ਪੰਜ ਅਗਸਤ ਉੱਨੀ ਸੌ ਚੌਵੀ